ਹੈਲੋ ਹਾਂਜੀ ਦੱਸੋ ਕੱਲ੍ਹ ਨੂੰ ਆ ਜਾਓ ਤੁਸੀਂ ਡਾਕਟਰ ਕੱਲ੍ਹ ਨੂੰ ਆਉਣਗੇ ਹਾਂਜੀ ਨਾਮ ਦੱਸੋ ਤੁਹਾਡਾ ਓਕੇ ਦਸ ਵਜੇ ਦਸ ਵਜੇ ਦਸ ਵਜੇ ਕੱਲ੍ਹ ਨੂੰ ਪਹੁੰਚ ਜਾਓ ਡਾਕਟਰ ਮਿਲ ਜਾਣਗੇ ਹਾਂਜੀ ਲੈ ਆਇਓ ਫਿਰ ਦੋ ਵਜੇ ਡਾਕਟਰ ਰੋਟੀ ਖਾਣ ਜਾਣਗੇ ਕਲ੍ਹ ਹੈ ਦਵਾਈ ਲੈ ਜਾਇਓ ਹਾਂਜੀ ਹੋ ਜਾਣਗੇ ਟੈਸਟ ਹਾਂ ਹਾਂਜੀ ਹਾਂ ਹਾਂਜੀ ਮਿਲ ਜਾਣਗੀਆਂ ਹਾਂਜੀ ਲੈ ਆਇਓ ਫਿਰ ਦੋ ਵਜੇ ਡਾਕਟਰ ਰੋਟੀ ਖਾਣ ਜਾਣਗੇ ਠੀਕ ਹੈ ਜੀ ਹਾਂਜੀ ਓਕੇ ਬਾਏ